ਟੈਕਨੋਲਜੀ ਬੈਂਕਿੰਗ ਨੂੰ ਬਹੁਤ ਆਸਾਨ ਬਣਾਇਆ ਹੈ ਹੁਣ ਅਸੀਂ ਕਿਧਰੇ ਵੀ ਪੇਮੈਂਟ ਕਰਨੀ ਹੋਵੇ ਜਾਂ ਕਿਸੇ ਨੂੰ ਪੈਸੇ ਭੇਜਣੇ ਹੋਣ ਘਰ ਬੈਠ ਕੇ ਹੀ ਭੇਜ ਸਕਦੇ ਹਾਂ ਲੈਣ ਦੇਣ ਦੀ ਪ੍ਰਕਿਰਿਆ ਕੈਸ਼ ਵਿੱਚ ਨਹੀਂ ਹੁੰਦੀ ਹੁਣ ਗੂਗਲ ਪੇ ਜਾਂ ਫੋਨਪੇ ਦੁਆਰਾ ਕਰ ਸਕਦੇ ਹਾਂ ਮੋਬਾਈਲ ਰਾਹੀਂ ਵੀ ਅਸੀਂ ਪੇਮੈਂਟ ਕਰ ਸਕਦੇ ਹਾਂ ਸਾਨੂੰ ਆਪਣੇ ਨਾਲ ਕੈਸ਼ ਰੱਖਣ ਲਈ ਦੀ ਜ਼ਰੂਰਤ ਨਹੀਂ ਹੈ ਇਹ ਸਭ ਇੱਕ ਟੈਕਨੋਲਜੀ ਦੀ ਹੀ ਦੇਣ ਹੈ